ਹੈਲੋ ਤੁਸੀਂ ਟਰਾਂਸਪੋਰਟ ਏਜੰਸੀ ਤੋਂ ਬੋਲ ਰਹੇ ਹੋ ਅਸੀਂ ਤੁਹਾਡੇ ਨਿਯਮਤ ਗਾਹਕ ਹਾਂ ਹਮੇਸ਼ਾ ਤੁਹਾਡੇ ਤੋਂ ਹੀ ਕੈਬ ਬੁੱਕ ਕਰਵਾਉਂਦੇ ਹਾਂ ਕਿਉਂਕਿ ਤੁਹਾਡਾ ਡਰਾਈਵਰ ਬਹੁਤ ਵਧੀਆ ਹੈ ਅਤੇ ਬਹੁਤ ਵਧੀਆ ਚਲਾਉਂਦਾ ਹੈ ਉਹਦਾ ਨੇਚਰ ਵੀ ਬਹੁਤ ਵਧੀਆ ਅਸੀਂ ਘਰ ਵਰਗਾ ਹੀ ਮਹਿਸੂਸ ਕਰਦੇ ਹਾਂ ਅਸੀਂ ਇਸ ਵਾਰ ਪੰਜਾਬ ਦੇ ਸਾਰੇ ਗੁਰਦੁਆਰੇ ਵੇਖਣਾ ਚਾਹੁੰਦੇ ਹਾਂ ਇਸ ਲਈ ਅਸੀਂ ਤੁਹਾਡੇ ਵੱਲੋਂ ਹੀ ਕੈਬ ਬੁੱਕ ਕਰਵਾਉਣੀ ਹੈ ਸਾਡੇ ਪਰਿਵਾਰ ਦੇ ਪੰਜ ਮੈਂਬਰ ਹਨ ਤੁਸੀਂ ਕਿੰਨੇ ਪੈਸੇ ਲਵੋਂਗੇ ਦਸ ਹਜ਼ਾਰ ਨਹੀਂ ਜੀ ਇਹ ਤਾਂ ਬਹੁਤ ਜ਼ਿਆਦਾ ਹੈ ਅਸੀਂ ਰਾਤ ਹੀ ਰਹਿਣਾ ਹੈ ਅਸੀਂ